ਹਰ ਇੱਕ ਕੰਮ ਲਈ ਸਾਡੀ ਮਨਪਸੰਦ ਕਿਸਮ ਦਾ ਇਲਾਕਾ ਜਿਹੜਾ ਉਹ ਉਹ ਹੈਗਾ ਪਹਾੜਾਂ 'ਤੇ ਬਰਫ਼ੀਲੇ ਪਹਾੜਾਂ ਦਾ ਇੱਥੇ ਅਸੀਂ ਕਈ ਵਾਰੀ ਦੇਖਿਆ ਏ ਜਿੱਥੇ ਬਰਫ ਪੈਂਦੀ ਆ ਬਹੁਤ ਹੀ ਵਧੀਆ ਉੱਥੋਂ ਦਾ ਵਾਤਾਵਰਨ ਕੀ ਹੈ ਜਿਹੜਾ ਬਹੁਤ ਵਧੀਆ ਪ੍ਰਦੂਸ਼ਣ ਹੈ ਹੀ ਨਹੀਂ ਬਿਲਕੁਲ ਉੱਥੇ ਜਿਹੜੇ ਕੁਦਰਤੀ ਸੋਮੇ ਆਗੇ ਉਹ ਬਹੁਤ ਨੇਗੇ ਪੜਾ ਪਹਾੜਾਂ 'ਤੇ ਅਤੇ ਬਰਫੀਲੇ ਪਹਾੜਾਂ 'ਤੇ ਜ਼ਿਆਦਾਤਰ ਕੀ ਹੈ ਉਸ ਏਰੀਏ ਦੇ ਵਿੱਚ ਬੰਦਾ ਮੈਂਟਲੀ ਓਰ ਫਿਜ਼ੀਕਲ ਫਿੱਟ ਰਹਿੰਦਾ ਇੱਕ ਤਾਂ ਪਹਾੜੀ ਏਰੀਆ ਹੋਣ ਕਰਕੇ ਜਿਹੜੀ ਐਕਸਰਸਾਈਜ਼ ਹੈ ਬੰਦੇ ਦੀ ਉਹ ਬਹੁਤ ਹੁੰਦੀ ਹੈ ਸਰੀਰ ਦੇ ਵਿੱਚ ਕੀ ਹੈ ਮੋਟਾਪਾ ਨਹੀਂ ਆਉਂਦਾ ਸਰੀਰ ਬਿਲਕੁਲ ਉਹਦਾ ਫਿੱਟ ਰਹਿੰਦਾ ਗਰਮੀ ਘੱਟ ਪੈਂਦੀ ਹੈੈ ਉੱਥੇ ਸਿਹਤ ਵੈਸੇ ਹੀ ਠੀਕ ਰਹਿੰਦੀ ਆ ਜਿਹੜੇ ਫਰੂਟ ਨੇ ਉੱਥੇ ਬਹੁਤ ਜ਼ਿਆਦਾ ਪਾਏ ਜਾਂਦੇ ਉਸ ਏਰੀਏ 'ਚ ਜਿੱਥੇ ਪਹਾੜ ਨੇ ਜਿਵੇਂ ਅਖਰੋਟ ਹੋ ਗਏ ਸੇਬਾਂ ਦੇ ਬਾਗ ਹੋ ਗਏ ਲੀਚੀ ਹੋ ਗਈ ਕੇਸਰ ਹੋ ਗਈ ਆਹ ਇਹ ਜਿਹੜਾ ਸਾਰਾ ਕੁਛ ਹੈ ਇਹ ਜਿੱਥੇ ਪਹਾੜ ਨੇ ਉਸ ਏਰੀਏ ਦੇ ਵਿੱਚ ਕੀ ਹੈ ਇਹ ਪਾਇਆ ਜਾਂਦਾ ਇਹ ਸਾਰੀਆਂ ਚੀਜ਼ਾਂ ਉੱਥੇ ਦੇਖਣ ਨੂੰ ਬਹੁਤ ਵਧੀਆ ਲੱਗੀਆਂ ਨੇ ਇੱਧਰ ਨਾਲੋਂ ਜਿੱਥੇ ਟੈਂਪਰੇਚਰ ਘੱਟ ਆ ਉੱਥੇ ਸਾਰਾ ਕੁਛ ਠੀਕ ਹੁੰਦਾ ਬਹੁਤ ਵਧੀਆ ਉਹ ਜਿਹੜਾ ਪਹਾੜਾਂ 'ਤੇ ਲੋਕ ਰਹਿੰਦੇ ਨੇ ਉਨ੍ਹਾਂ ਦਾ ਏਰੀਆ ਬਹੁਤ ਵਧੀਆ ਜਿਹੜੇ ਸਾਧਨ ਉਨ੍ਹਾਂ ਕੋਲ ਫਰੂਟ ਹੈ ਹੋਰ ਧੰਦਾ ਜਿਹੜਾ ਵੀ ਕਰਦੇ ਆ ਉਹ ਉਹ ਬਹੁਤ ਵਧੀਆ ਲੱਗਿਆ ਸਾਨੂੰ ਦੇਖਣ ਨੂੰ ਧੰਨਵਾਦ ਜੀ